ਭੰਗੜਾ ਐਰੋਬਿਕਸ ਇੱਕ ਵਰਕਆਊਟ ਹੈ ਜਿਹੜਾ ਜਿਮ ਜਿਮ ਅਤੇ ਲੋਕੀ ਕਈ ਘਰਾਂ ਵਿੱਚ ਵੀ ਸਿਖਾਂਦੇ ਹਨ ਭੰਗੜਾ ਐਰੋਬਿਕਸ ਇੱਕ ਪਤਲੇ ਹੋਣ ਦਾ ਜਰੀਆ ਹੈ ਅਤੇ ਫਿਟ ਹੋਣ ਦਾ ਜਰੀਆ ਹੈ ਜਿਹਦੇ ਕਰਕੇ ਲੋਕੀ ਪਤਲੇ ਵੀ ਹੁੰਦੇ ਹਨ ਪਹਿਲਾਂ ਜਿਮ ਵਿੱਚ ਸਿਰਫ ਐਕਸਰਸਾਈਜ ਕਰਾਈਆਂ ਜਾਂਦੀਆਂ ਸੀ ਕਸਰਤ ਕਰਾਈਆਂ ਜਾਂਦੀਆਂ ਸੀ ਪਰ ਹੁਣ ਭੰਗੜਾ ਐਰੋਬਿਕਸ ਦਾ ਵੀ ਟਰੈਂਡ ਆ ਚੁੱਕਾ ਹੈ ਕਿਉਂਕਿ ਆਪਣਾ ਕਲਚਰ ਹੀ ਪੰਜਾਬੀ ਹੈ ਤੇ ਲੋਕੀ ਇੱਥੇ ਭੰਗੜਾ ਕਰਨਾ ਬਹੁਤ ਪਸੰਦ ਕਰਦੇ ਹਨ ਇਹ ਚੀਜ਼ ਨੂੰ ਇੰਜੋਏ ਕਰਕੇ ਕਰਦੇ ਹਨ ਉਹਨਾਂ ਭੰਗੜਾ ਰੋਬਿਕਸ ਨਾਲ ਵੀ ਉਹਨਾਂ ਨੂੰ ਬਹੁਤ ਮਦਦ ਮਿਲਦੀ ਹੈ ਇਹ ਚਿੰਤਾ ਅਤੇ ਬੁਖਾਰ ਖਾਂਸੀ ਜੁਖਾਮ ਸਾਰੇ ਤਬੀਅਤਾਂ ਤੋਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ ਤੇ ਇੱਕ ਟਾਈਮ ਤੇ ਮੈਂ ਵੀ ਜਿਮ ਚ ਜਾ ਕੇ ਭੰਗੜਾ ਰੋਬਿਕਸ ਕਰਦੀ ਸੀ ਮੈਨੂੰ ਬਹੁਤ ਪਸੰਦ ਆਇਆ ਫਿਰ ਮੈਂ ਉਥੋਂ ਸਿੱਖਿਆ ਤੇ ਅੱਜ ਮੈਂ ਵੀ ਇੱਕ ਭੰਗੜਾ ਐਰੋਬਿਕਸ ਦੀ ਟੀਚਰ ਬਣ ਗਈਆਂ ਤੇ ਮੈਂ ਵੀ ਲੋਕਾਂ ਨੂੰ ਭੰਗੜਾ ਸਿਖਾਨੀ ਆ ਤੇ ਲੋਕੀ ਵੀ ਬਹੁਤ ਖੁਸ਼ ਹੋ ਕੇ ਮੇਰੇ ਨਾਲ ਭੰਗੜਾ ਰੋਬਿਕਸ ਕਰਦੇ ਹਨ ਤੇ ਇਹ ਭੰਗੜਾ ਰੋਬਿਕਸ ਦਾ ਨਾਮ ਮੈਂ ਪਹਿਲੀ ਵਾਰੀ ਥੋੜੇ ਸਾਲ ਪਹਿਲਾਂ ਸੁਣਿਆ ਸੀ ਜਦੋਂ ਮੈਂ ਜਿਮ ਚ ਪਤਲੇ ਹੋਣ ਲਈ ਗਈ ਸੀ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਇੱਥੇ ਕਸਰਤ ਦੇ ਨਾਲ ਨਾਲ ਭੰਗੜਾ ਰੋਪਿਕਸ ਵੀ ਕਰਾਨੇ ਆ ਜਿਹਦੇ ਨਾਲ ਤੁਹਾਨੂੰ ਪਤਲੇ ਹੋਣ ਚ ਮਦਦ ਮਿਲੂਗੀ